ਸਾਡੇ ਨਾਗਰਿਕਾਂ ਨੂੰ ਜੇਕਰ ਬੈਂਕਿੰਗ ਦੇ ਨਾਲ ਸੰਬੰਧਿਤ ਦੇਖਿਆ ਜਾਵੇ ਤਾਂ ਸਰਕਾਰਾਂ ਚਲੋ ਕਾਫੀ ਇਸ ਵਾਰ ਹੁਣ ਥੋੜ੍ਹੇ ਪਿਛਲੇ ਕੁਝ ਸਮੇਂ ਤੋਂ ਕਾਫੀ ਉਤਸ਼ਾਹਿਤ ਹਨ ਅਤੇ ਜਿਸ ਨਾਲ ਸੌਖਾ ਵੀ ਹੋ ਰਿਹਾ ਹੈ ਬੈਂਕਿੰਗ ਨੂੰ ਜਿਵੇਂ ਇੰਟਰਨੈਟ ਬੈਂਕਿੰਗ ਜਾਂ ਤੁਸੀਂ ਏ ਟੀ ਐੱਮ ਦੀ ਸੁਵਿਧਾ ਦੇਣੀ ਕੁਝ ਇੱਦਾਂ ਦੇ ਕਰਕੇ ਹਰ ਇੱਕ ਨਾਗਰਿਕ ਜਿੰਨੇ ਕੁ ਯੋਗਤਾ ਯੋਗਾ ਹੈਗਾ ਉਹ ਉਸ ਤਰੀਕੇ ਨਾਲ ਆਪਣਾ ਜਿਹੜਾ ਕੰਮ ਕਰਦਾ ਹੈਗਾ ਜਿੱਦਾ ਕਿਸੇ ਨੇ ਨੈਟ ਬੈਂਕਿੰਗ ਕਰਨੀ ਹੈ ਕੋਈ ਪੇਮੈਂਟ ਕਰਨੀ ਹੈ ਇਧਰੋਂ ਉਧਰ ਕਰਨੀ ਹੈ ਤਾਂ ਉਹ ਆਪਣੇ ਲੈਪਟੋਪ ਤੋਂ ਜਾਂ ਕੰਪਿਊਟਰ ਤੋਂ ਜਾਂ ਆਪਣੇ ਮੋਬਾਈਲ ਤੋਂ ਕਰ ਸਕਦਾ ਹੈਗਾ ਜਿਸ ਦੇ ਨਾਲ ਬੜਾ ਸੌਖਾ ਕੰਮ ਹੈ ਉਸ ਤੋਂ ਬਾਅਦ ਗੌਰਮੈਂਟ ਨੇ ਇੱਕ ਬੜਾ ਵਧੀਆ ਐਪ ਸਕੈਨਰ ਚਲਾਏ ਹਨ ਜਿੱਦਾਂ ਕਿ ਪੇ ਟੀ ਐੱਮ ਰਾਹੀਂ ਆਪਾਂ ਕਿਸੇ ਨੂੰ ਕੋਈ ਪੇਮੈਂਟ ਕਰਨੀ ਹੈ ਉਹ ਕਰ ਸਕਦੇ ਹਾਂ ਜਾਂ ਗੂਗਲ ਪੇ ਐਪ ਹੈਗੀ ਆ ਇੱਕ ਉਸ ਦੇ ਨਾਲ ਆਪਾਂ ਕਿਸੇ ਨੂੰ ਕਿਸੇ ਦੂਰ ਪੈਸੇ ਭੇਜਣੇ ਹਨ ਉਹ ਭੇਜ ਸਕਦੇ ਹੋ ਹਾਂ ਇਹੋ ਜਿਹੀਆਂ ਯੋਜਨਾਵਾਂ ਦੀ ਜ਼ਰੂਰਤ ਵੀ ਬਹੁਤ ਸੀ ਕਿਉਂਕਿ ਅੱਜ ਕੱਲ੍ਹ ਸਮਾਂ ਵੀ ਸਾਰਿਆਂ ਕੋਲ ਘੱਟ ਹੈ ਅਤੇ ਸਮਾਂ ਘੱਟ ਹੋਣ ਕਰਕੇ ਤੁਸੀਂ ਜਾਣ ਆਉਣ ਦੀ ਬਜਾਏ ਤੁਸੀਂ ਆਪਣੇ ਮੋਬਾਇਲ ਤੋਂ ਆਪਣੀ ਨੈੱਟ ਬੈਂਕਿੰਗ ਰਾਹੀਂ ਪੇਮੈਂਟ ਕਰ ਸਕਦੇ ਹੋ ਹਾਂ ਕੁਝ ਇਸ ਦੇ ਵਿੱਚ ਥੋੜ੍ਹੀਆਂ ਜਿਹੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ